ਨਹੀਂ ਜੀ ਮੈਂ ਕਦੇ ਵੀ ਮੈਰਾਥੋਂਨ ਜਾਂ ਹੋਰ ਲੰਬੀ ਦੂਰੀ ਦੀ ਦੌੜ ਵਿੱਚ ਕਦੇ ਹਿੱਸਾ ਨਹੀਂ ਲਿਆ ਮੇਰੀ ਰੁਚੀ ਨਹੀਂ ਸੀ ਦੌੜ ਦੇ ਵਿੱਚ ਇਸ ਕਰਕੇ ਮੈਨੂੰ ਇਹਦਾ ਕੋਈ ਵੀ ਤਜ਼ਰਬਾ ਨਹੀਂ ਹੈ ਇਹਦੇ ਬਾਰੇ ਮੈਂ ਕੁਛ ਨਹੀਂ ਕਹਿ ਸਕਦਾ ਜੇ ਕਿ ਲਿਆ ਹੁੰਦਾ ਇਹੋ ਜਿਹਾ ਹਿੱਸਾ ਫਿਰ ਮੈਂ ਤੁਹਾਨੂੰ ਸਾਰੀ ਡਿਟੇਲ ਦੱਸ ਦੇਣੀ ਕਿ ਤਿਆਰੀ ਕਿੱਦਾਂ ਕੀਤੀ ਕਿੱਥੋਂ ਕੀਤੀ ਲੇਕਿਨ ਨਹੀਂ ਮੈਂ ਕੋਈ ਹਿੱਸਾ ਨਹੀਂ ਲਿਆ ਇਹਦੇ 'ਚ ਇਹਦੇ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈ ਜੀ ਧੰਨਵਾਦ ਜੀ